ਚੁੱਲ੍ਹੇ 'ਤੇ ਸਿੱਧੀ ਅੱਗ 'ਤੇ ਜਾਂ ਤਾਂ ਅਸੀਂ ਸਾਗ ਰਿੰਨਦੇ ਹੁੰਦੇ ਹਾਂ ਅਤੇ ਉਹ ਚੁੱਲ੍ਹੇ ਵਾਲੀ ਚੀਜ਼ ਦਾ ਅੱਡ ਏ ਸਵਾਦ ਹੁੰਦਾ ਕਿਉਂਕਿ ਉਹਦੇ 'ਤੇ ਉਹ ਚੀਜ਼ ਖੁੱਲ੍ਹੀ ਰਿੱਝਦੀ ਆ ਉਹਨੂੰ ਸਮਾਂ ਲੱਗਦਾ ਬਣਨ 'ਚ ਅਤੇ ਜੇ ਆਪਾਂ ਗੈਸ ਇੰਡਕਸ਼ਨ ਦੀ ਗੱਲ ਕਰੀਏ ਤਾਂ ਆਪਾਂ ਇੱਥੇ ਇੱਕ ਸੀਟੀ ਮਰਾਣ ਦੀ ਗੱਲ ਕਰਦੇ ਹਾਂ ਕੁੱਕਰ ਧਰ ਕੇ ਜੋ ਕਿ ਉਸ ਚੀਜ਼ ਦਾ ਇੰਨਾਂ ਸਵਾਦ ਨਹੀਂ ਆਉਂਦਾ ਨਾ ਦਾਲ ਚੰਗੀ ਤਰ੍ਹਾਂ ਗਲ਼ਦੀ ਆ ਜੋ ਸਵਾਦ ਚੁੱਲ੍ਹੇ 'ਚ ਹੈ ਉਹ ਚੁੱਲ੍ਹੇ 'ਚ ਹੀ ਹੈ